ਸਾਨੂੰ ਖੇਡਾਂ ਦੇ ਵਧੀਆ ਵਧੀਆ ਮੈਦਾਨ ਬਣਾਉਣੇ ਚਾਹੀਦੇ ਹਨ ਜਿਹਦੇ ਵਿੱਚ ਸਾਰੇ ਬੱਚੇ ਖੇਡਾਂ ਖੇਡ ਸ ਸਕਣ ਖੇਡਾਂ ਖੇਡਣ ਨਾਲ ਸਰੀਰਕ ਤੌਰ 'ਤੇ ਬਹੁਤ ਜ਼ਿਆਦਾ ਸਰੀਰ ਨੂੰ ਫਾਇਦੇ ਮਿਲਦੇ ਹਨ ਜੋ ਸਾਡੀ ਪੋਜ਼ੀਟੀਵਿਟੀ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਹੈ